ਸਾਡੇ ਖੇਤਰ ਵਿੱਚ ਕਣਕ ਮੱਕੀ ਝੋਨਾ ਇਹ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ ਹਨ ਕਣਕ ਠੰਡ ਦੇ ਸਮੇਂ ਵਿੱਚ ਬੀਜੀ ਜਾਂਦੀ ਹੈ ਅਤੇ ਬਰਸਾਤਾਂ ਦੇ ਸਮੇਂ ਵਿੱਚ ਝੋਨਾ ਬੀਜਿਆ ਜਾਂਦਾ ਹੈ ਅਤੇ ਅਪ੍ਰੈਲ ਮਹੀਨੇ ਵਿੱਚ ਗਰਮੀ ਦੇ ਟਾਈਮ ਵਿੱਚ ਮੱਕੀ ਬੀਜੀ ਜਾਂਦੀ